ਘਰ 'ਚ ਖਾਣਾ ਪਕਾਉਣ ਲਈ ਜੋ ਐੱਲ ਪੀ ਜੀ ਸਿਲੰਡਰ ਦੀ ਵਰਤੋਂ ਕਰਦੇ ਹੈ ਉਹਦੇ ਵਿੱਚ ਸਾਨੂੰ ਸਭ ਤੋਂ ਵੱਡੀ ਗੱਲ ਹੈ ਜਦੋਂ ਅਸੀਂ ਸਿਲੰਡਰ ਨਵਾਂ ਸਿਲੰਡਰ ਲਾਉਂਦੇ ਹਾਂ ਅਤੇ ਉਹਦਾ ਜੋ ਰੈਗੂਲੇਟਰ ਆ ਉਹ ਸਾਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਚਾਹੀਦਾ ਹੈ ਵੀ ਲੱਗਿਆ ਹੈ ਕਿ ਨਹੀਂ ਲੱਗਿਆ ਹੈ ਕਈ ਵਾਰ ਅਸੀਂ ਰੈਗੂਲੇਟਰ ਲਾ ਤਾਂ ਦਿੰਦੇ ਹਾਂ ਪਰ ਉਹ ਥੋੜ੍ਹਾ ਜਿਹਾ ਉੱਪਰ ਰਹਿ ਜਾਂਦਾ ਹੈ ਜਿਸ ਕਰਕੇ ਉਹਦੀ ਗੈਸ ਹੈ ਥੋੜ੍ਹੀ ਥੋੜ੍ਹੀ ਜਿਹੀ ਲੀਕੇਜ ਹੋਈ ਜਾਂਦੀ ਹੈ ਅਤੇ ਉਹ ਸਾਡੇ ਵਾਸਤੇ ਖਤਰੇ ਦਾ ਕਾਰਨ ਬਣ ਸਕਦੀ ਹੈ ਦੂਸਰੇ ਨੰਬਰ 'ਤੇ ਜਿਸ ਤਰ੍ਹਾਂ ਕਿ ਅਸੀਂ ਖਾਣਾ ਬਣਾਉਂਦੇ ਹੈ ਅਤੇ ਕਈ ਵਾਰੀ ਕੀ ਹੁੰਦਾ ਹੈ ਕੋਈ ਖਾਣਾ ਮਤਲਬ ਕਿ ਸਬਜ਼ੀ ਵਗੈਰਾ ਜਾਂ ਕੁੱਕਰ ਦੇ ਵਿੱਚ ਧਰ ਕੇ ਇੱਧਰ ਉੱਧਰ ਚਲੇ ਜਾਂਦੇ ਹਾਂ ਕਈ ਵਾਰੀ ਫੋਨ ਆ ਜਾਂਦਾ ਜਾਂ ਆਰਾਮ ਕਰਨ ਲੱਗ ਜਾਂਦੇ ਹਾਂ ਤਾਂ ਉਸ ਸਮੇਂ ਕੀ ਹੁੰਦਾ ਵੀ ਅਸੀਂ ਉਹਨੂੰ ਘੱਟ 'ਤੇ ਕਰ ਦਿੰਦੇ ਹਾਂ ਸਟੋਵ ਨੂੰ ਅਤੇ ਪੈ ਜਾਂਦੇ ਹਾਂ ਜਾਂ ਫੋਨ ਕਰਨ ਸੁਣਨ ਲੱਗ ਜਾਂਦੇ ਹਾਂ ਅਤੇ ਜਿਹੜੀ ਚੀਜ਼ ਉੱਪਰ ਪੱਕ ਰਹੀ ਹੁੰਦੀ ਆ ਉਹ ਉੱਬਲ ਕੇ ਉਹਨੂੰ ਅੱਗ ਨੂੰ ਬੁਝਾ ਦਿੰਦੀ ਆ ਅਤੇ ਉਹ ਜਿਹੜਾ ਆਪਣਾ ਸਟੋਵ ਦਾ ਉਹ ਗੈਸ ਦਾ ਖੁੱਲ੍ਹਾ ਰਹਿ ਜਾਂਦਾ ਵਰਨਰ ਅਤੇ ਉਹ ਹੌਲੀ ਹੌਲੀ ਗੈਸ ਲੀਕ ਹੋ ਜਾਂਦੀ ਹੈ ਅਤੇ ਉਹ ਬਹੁਤ ਬੜਾ ਖਤਰਾ ਬਣ ਜਾਂਦੀ ਹੈ ਸਾਡੇ ਵਾਸਤੇ ਤੀਸਰੇ ਨੰਬਰ 'ਤੇ ਜਦ ਖਾਣਾ ਬਣਾਉਣੇ ਵਾਲੀ ਕੋਈ ਵੀ ਬੰਦਾ ਜਾਂ ਜਨਾਨੀ ਹੈ ਔਰਤ ਹੈ ਉਹ ਇੱਕ ਆਪਣਾ ਜਿਹੜੇ ਕੱਪੜਾ ਹੈ ਸੂਤੀ ਪਾ ਕੇ ਰੱਖੇ ਕਦੇ ਵੀ ਕੋਈ ਹਾਦਸਾ ਹੁੰਦਾ ਹੈ ਅਤੇ ਉਹਦੇ ਨਾਲ ਆਪਣੇ ਸਰੀਰ ਦਾ ਬਚਾਅ ਹੋ ਜਾਂਦਾ ਹੈ ਅਤੇ ਇੱਕ ਹੋਰ ਕਾਰਨ ਹੈ ਜਿਹੜੀਆਂ ਆਪਾਂ ਪਾਈਪਾਂ ਯੂਜ਼ ਕਰਦੇ ਹੈ ਉਹ ਵਧੀਆ ਕਿਸਮ ਦੀ ਹੋਣੀ ਚਾਹੀਦੀ ਹੈ ਸਰਦੀ ਗਰਮੀ ਦੇ ਵਿੱਚ ਇਹ ਕਰੈੱਕ ਕਰ ਜਾਂਦੀਆਂ ਹੈ ਇਨ੍ਹਾਂ ਨੂੰ ਟਾਈਮ ਟਾਈਮ 'ਤੇ ਸਮੇਂ ਸਮੇਂ ਦੇ ਉੱਤੇ ਦੇਖਦੇ ਰਹਿਣਾ ਚਾਹੀਦਾ ਵੀ ਕੋਈ ਸਾਡੀ ਪਾਈਪ ਕਰੈੱਕ ਤਾਂ ਨਹੀਂ ਹੋਈ ਵੀ ਆ ਅਤੇ ਜੇ ਅਸੀਂ ਇਹਦੀ ਪਰੋਪਰ ਚੈੱਕਿੰਗ ਕਰਦੇ ਰਹਾਂਗੇ ਤਾਂ ਖਤਰੇ ਤੋਂ ਬਚ ਸਕਦੇ ਹਾਂ ਅਤੇ ਅੱਜ ਕੱਲ੍ਹ ਸ਼ਹਿਰ ਸ਼ਹਿਰ ਗਲੀਆਂ ਗਲੀਆਂ ਦੇ ਵਿੱਚ ਅੱਜ ਕੱਲ੍ਹ ਪਾਈਪਾਂ ਪਾਈ ਜਾ ਰਹੀਆਂ ਹੈ ਗੈਸ ਦੀ ਸਿੱਧੀ ਸਪਲਾਈ ਆ ਰਹੀ ਹੈ ਅਤੇ ਉਹਦੀ ਜਿਹੜੀ ਪਾਈਪਾਂ ਦੀ ਕਿਸਮ ਹੈ ਉਹ ਵਧੀਆ ਕੁਆਲਿਟੀ ਦੀ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਗੈਸ ਲੀਕੇਜ ਦਾ ਖਤਰਾ ਨਾ ਹੋਵੇ ਤਾਂ ਇਨ੍ਹਾਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਸੁਰੱਖਿਆ ਨਿਸ਼ਚਿਤ ਕੀਤੀ ਜਾਵੇ